ਮੈਂ ਸਾਡੇ ਪਿੰਡ ਚੋਣਾਂ ਕਰਕੇ ਸਾਰਾ ਟਾਈਮ ਚੋਣਾਂ ਦੇ ਵਿੱਚ ਵਿਅਸਤ ਸੀ ਜਿਹਦੇ ਕਰਕੇ ਮੈਂ ਤਾਂ ਬਹੁਤ ਬੋਰ ਹੋਈ ਪਈ ਹਾਂ ਹੁਣ ਤਾਂ ਮੈਨੂੰ ਬਸ ਇਹ ਹੈ ਕਿ ਕੋਈ ਦਿਲਚਸਪ ਜਿਹੀ ਵਧੀਆ ਕੋਈ ਹਾਸੇ ਵਾਲੀ ਫਿਲਮ ਮਿਲ ਜੇ ਜਿਹਦੇ ਜਿਹਨੂੰ ਵੇਖ ਕੇ ਮੇਰਾ ਪੂਰਾ ਦਿਲ ਖੁਸ਼ ਹੋਜੇ ਜਿਹਦੇ ਨਾਲ ਮੇਰੇ ਮਨ ਦੀਆਂ ਸਾਰੀਆਂ ਫਿਕਰਾਂ ਦੂਰ ਹੋ ਜਾਣ ਸਾਰਾ ਜਿਹੜਾ ਇੰਨੇ ਦਿਨਾਂ ਦਾ ਮੂਡ ਸਰਪੰਚੀ ਦੀਆਂ ਚੋਣਾਂ ਵਿੱਚ ਖਰਾਬ ਹੋਇਆ ਹੋਇਆ ਸੀ ਚੋਣਾਂ ਦੇ ਕਿੱਸੇ ਸੁਣ ਸੁਣ ਕੇ ਕਿਸੇ ਦੀਆਂ ਗਾਲਾਂ ਕਿਸੇ ਦੇ ਕਿਸੇ ਦੀਆਂ ਲੜਾਈਆਂ ਸੁਣ ਸੁਣ ਕੇ ਹੁਣ ਬਸ ਇਹ ਆ ਕਿ ਕੋਈ ਵਧੀਆ ਜਿਹੀ ਅੱਜ ਰਾਤ ਨੂੰ ਫਿਲਮ ਵੇਖੀ ਜਾਵੇ ਜਿਹਦੇ ਨਾਲ ਆਪਣੇ ਜਿਹੜੇ ਮਨ ਦੇ ਹੈਗੇ ਆ ਸਾਰੇ ਜਿਹੜੇ ਹੈਗੇ ਆਪਣੇ ਮਨ ਦੀਆਂ ਜਿਹੜੀਆਂ ਵੀ ਆਪਣੀਆਂ ਗੱਲਾਂ ਨੇ ਉਹ ਦੂਰ ਹੋ ਜਾਣ ਅਤੇ ਆਪਾਂ ਜਿਹੜੇ ਚੰਗਾ ਖੁਸ਼ੀ ਨਾਲ ਆਪਾਂ ਆਪਦਾ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਖੁਸ਼ੀ ਮਿਲੇ ਜਿਹੜੀ ਫਿਲਮ ਵੇਖ ਕੇ ਇਹਦੇ ਵਾਸਤੇ ਮੈਂ ਆਪਦੀ ਫਰੈਂਡ ਨੂੰ ਵੀ ਪੁੱਛਿਆ ਅਤੇ ਉਹਨੇ ਮੈਨੂੰ ਬਹੁਤ ਸਾਰੀਆਂ ਫਿਲਮਾਂ ਦੀ ਸਿਫਾਰਸ਼ ਕੀਤੀ ਕਿ ਤੂੰ ਆਹ ਵੇਖ ਆਹ ਵੇਖ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਹੜੀ ਫਿਲਮ ਵੇਖਾਂ ਜਿਹੜੀ ਵੇਖ ਕੇ ਮੇਰਾ ਮਨ ਖੁਸ਼ ਹੋਜੇ ਅਤੇ ਜਿਹਦੇ ਨਾਲ ਬਹੁਤ ਸਾਰੀਆਂ ਫਿਲਮਾਂ ਆਪਣੇ ਇੱਥੇ ਪੰਜਾਬੀ ਫਿਲਮਾਂ ਨੇ ਜਿਹੜੀਆਂ ਬੜਾ ਆਪਣਾ ਮਨੋਰੰਜਨ ਕਰਦੀਆਂ ਹਨ ਅਤੇ ਉਹਨਾਂ ਵਿੱਚੋਂ ਜਿਵੇਂ ਕਿ ਗਿੱਪੀ ਗਰੇਵਾਲ ਹੋ ਗਏ ਐਮੀ ਵਿਰਕ ਹੋ ਗਏ ਉਹਨਾਂ ਦੀ ਫਿਲਮਾਂ ਬਹੁਤ ਪਸੰਦ ਨੇ ਮੈਨੂੰ ਮੈਂ ਅੱਜ ਰਾਤ ਨੂੰ ਪੰਜਾਬੀ ਫਿਲਮ ਵੇਖਣਾ ਚਾਹੁੰਦੀ ਹਾਂ ਜਿਹੜੀ ਵੇਖ ਕੇ ਮੈਂ ਚੰਗੀ ਤਰ੍ਹਾਂ ਜਿਹਨੂੰ ਵੇਖ ਕੇ ਆਪਣਾ ਜੀ ਖੁਸ਼ ਹੋਜੇ ਜਿਵੇਂ ਕਿ ਪੰਜਾਬੀ ਫਿਲਮ ਹੈਗੀ ਆ ਜੱਟ ਐਂਡ ਜੂਲੀਅਟ ਥ੍ਰੀ ਉਹ ਵੇਖਣਾ ਚਾਹੁੰਦੀ ਹਾਂ ਜ ਜਿਹੜੀ ਸੁਣ ਕੇ ਆਪਣਾ ਜਿਹੜਾ ਹੈਗਾ ਮਨ ਖੁਸ਼ ਹੋਜੇ ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਹੜੀ ਫਿਲਮ ਵੇਖਾਂ ਜਿਹੜੀ ਮੈਨੂੰ ਬਹੁਤ ਚੰਗੀ ਲੱਗੇ ਅਤੇ ਜਿਹੜੀ ਚੋਣਾਂ ਤੋਂ ਆਪਾਂ ਇੰਨਾ ਬੋਰ ਹੋਏ ਪਏ ਸੀ ਉਹ ਆਪਣਾ ਮਨ ਜਿਹੜਾ ਖੁਸ਼ ਹੋਜੇ ਮੈਂ ਚਾਹੁੰਦੀ ਹਾਂ ਕੋਈ ਨਾ ਕੋਈ ਫਿਲਮ ਜ਼ਰੂਰ ਵੇਖੀ ਜਾਵੇ ਅੱਜ